ਸੰਗੀਤ ਵਿੱਚ ਬਹੁਤ ਤਰ੍ਹਾਂ ਦੇ ਸਾਜ ਆਉਂਦੇ ਹਨ ਜਿਵੇਂ ਢੋਲ ਗਿਟਾਰ ਐਨਮੋਨੀਅਮ ਚਿਮਟਾ ਆਦਿ ਮੈਨੂੰ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਢੋਲ ਬਾਰੇ ਪਤਾ ਹੈ ਜਿਵੇਂ ਕਿ ਨਗਾਰਾ ਡਕਾ ਡਕਾ ਆਦਿ ਮੈਂ ਢੋਲ ਨੂੰ ਸਭ ਤੋਂ ਪਹਿਲਾਂ ਇੱਕ ਦੁਕਾਨ ਤੋਂ ਖਰੀਦ ਕੇ ਲਿਆਇਆ ਅਤੇ ਉਸ ਨੂੰ ਹੌਲ਼ੀ ਹੌਲ਼ੀ ਵਜਾਉਣਾ ਸਿੱਖ ਲਿਆ ਜਦੋਂ ਵੀ ਕੋਈ ਤਿਉਹਾਰ ਜਾਂ ਮੇਲਾ ਜਾਂ ਵਿਆਹ ਹੁੰਦਾ ਹੈ ਤਾਂ ਮੈਂ ਉਸ ਢੋਲ ਨੂੰ ਵਜਾਉਂਦਾ ਹਾਂ ਜਿਵੇਂ ਕੋਈ ਦਰਗਾਹ 'ਤੇ ਲੋੜ ਹੋਵੇ ਤਾਂ ਮੈਂ ਉਸ ਢੋਲ ਨੂੰ ਵਜਾਉਂਦਾ ਹਾਂ ਸਭ ਤੋਂ ਪਹਿਲਾਂ ਉਸ ਨੂੰ ਸਹੀ ਢੰਗ ਨਾਲ਼ ਕਿਸੇ ਕਵਰ ਵਿੱਚ ਰੱਖਣਾ ਪੈਂਦਾ ਹੈ ਅਤੇ ਉਸ ਨੂੰ ਉਸ ਤੋਂ ਬਾਅਦ ਜਦੋਂ ਵੀ ਕੋਈ ਤਿਉਹਾਰ ਜਾਂ ਵਿਆਹ ਹੋਵੇ ਉਸ ਨੂੰ ਉੱਥੇ ਲੈ ਕੇ ਜਾਂਦਾ ਹਾਂ ਤਾਂ ਉਸਨੂੰ ਕਵਰ ਵਿੱਚੋਂ ਕੱਢ ਕੇ ਢੋਲ ਦੀ ਪੂਰੀ ਤਰ੍ਹਾਂ ਕਸਾਈ ਕਰਦਾ ਹਾਂ ਉਸ ਢੋਲ ਦੇ ਸਾਜ ਚੈੱਕ ਕਰਦਾ ਹਾਂ ਉਸ ਦੀ ਆਵਾਜ਼ ਚੈੱਕ ਕਰਦਾ ਹਾਂ ਅਤੇ ਫਿਰ ਮੈਂ ਉਸ ਢੋਲ ਨੂੰ ਬੜੀ ਰੂਹ ਨਾਲ਼ ਵਜਾਉਂਦਾ ਹਾਂ ਇਸ ਕਰਕੇ ਮੈਨੂੰ ਢੋਲ ਵਜਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਮੈਂ ਢੋਲ ਦੇ ਡਗੇ 'ਤੇ ਕਈ ਤਰ੍ਹਾਂ ਦੇ ਸੰਗੀਤ ਵੀ ਗਾ ਲੈਂਦਾ ਹਾਂ ਮੈਨੂੰ ਇਸ ਕਰਕੇ ਸੰਗੀਤ ਨਾਲ਼ ਬਹੁਤ ਜ਼ਿਆਦਾ ਪਿਆਰ ਹੈ ਮੈਂ ਕਈ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮਾਂ 'ਤੇ ਵੀ ਸੰਗੀਤ ਨੂੰ ਗਾ ਸਕਦਾ ਹਾਂ ਪਰ ਬੜੇ ਪ੍ਰੋਗਰਾਮਾਂ ਵਿੱਚ ਕਦੇ ਵੀ ਮੈਂ ਇਸ ਸੰਗੀਤ ਦਾ ਜ਼ਿਕਰ ਨਹੀਂ ਕੀਤਾ ਪਰ ਜੇ ਕੋਈ ਸੁਰ ਦੀ ਗੱਲ ਹੋਵੇ ਜਿਵੇਂ ਸਾ ਰੇ ਗਾ ਮਾ ਪਾ ਦਾ ਨੀ ਸਾ ਨੀ ਸਾ ਦਾ ਪਾ ਮ ਗ ਰੇ ਸਾ ਆਦਿ ਦਾ ਪ੍ਰਯੋਗ ਕਰਕੇ ਇਸ ਸੁਰ ਨੂੰ ਲਾਇਆ ਜਾਂਦਾ ਹੈ ਅਤੇ ਉਸ ਨੂੰ ਸੰਗੀਤ ਕਿਹਾ ਜਾਂਦਾ ਹੈ